ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਮਾਨ ਸਿੰਘ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਕਨੇਡਾ ਜਾਣਾ ਚਾਹਵਾਂਗਾ ਕਿ ਕਨੇਡਾ ਇੱਕ ਇਹੇ ਜਿਹੀ ਕੰਟਰੀ ਹੈ ਜਿੱਥੇ ਬਹੁਤ ਹੀ ਫਲਸਿਟੀਆਂ ਦਿੱਤੀਆਂ ਜਾਂਦੀਆਂ ਜੇਕਰ ਆਪਾਂ ਉੱਥੇ ਸਾਫ਼ ਸਫਾਈ ਦੀ ਗੱਲ਼ ਕਰੀਏ ਤਾਂ ਬਹੁਤ ਹੀ ਵਧੀਆ ਹੈ ਅਤੇ ਉੱਥੇ ਇਹ ਚਾਰੇ ਹੀ ਪਾਸੇ ਹਰਿਆਲੀ ਹੈ ਜੇਕਰ ਉਹਨਾਂ ਦੀ ਸਰਕਾਰਾਂ ਦੀ ਗੱਲ ਕਰੀਏ ਉੱਥੇ ਦੀਆਂ ਸਰਕਾਰਾਂ ਵੀ ਬਹੁਤ ਹੀ ਵਧੀਆ ਹੈ ਅਤੇ ਉੱਥੇ ਹ ਬਹੁਤ ਹੀ ਜ਼ਿਆਦਾ ਘੁੰਮਣ ਨੂੰ ਹੈ ਜਿੱਦਾਂ ਜਿਵੇਂ ਕਿ ਬਹੁਤ ਹੀ ਜ਼ਿਆਦਾ ਸਮੀਨਿੰਗ ਪੂਲ ਹੈ ਨੇ ਅਤੇ ਬਹੁਤ ਹੀ ਜ਼ਿਆਦਾ ਵਧੀਆ ਵਧੀਆ ਬਿਲਡਿੰਗਾਂ ਹੈ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਦੀਆਂ ਹਨ ਅਤੇ ਉੱਥੇ ਹਰ ਸਮੁੰਦਰ ਬਹੁਤ ਹੀ ਜ਼ਿਆਦਾ ਸਮੁੰਦਰ ਹਨ ਜਿਹਨਾਂ ਵਿੱਚ ਮੈਂ ਕਿਸ਼ਤੀਆਂ ਕਿਸ਼ਤੀਆਂ ਪਸੰਦ ਕਰਦਾ ਹਾਂ